ਹੈਲੋ ਕੁਲਦੀਪ ਸਿੰਘ ਬੋਲਦਾ ਜੀ ਮੈਂ ਪਰਮਜੀਤ ਬੋਲਦਾ ਤੁਹਾਡੇ ਦੋਸਤ ਨੇ ਮੈਨੂੰ ਨੰਬਰ ਦਿੱਤਾ ਸੀਗਾ ਆਪਾਂ ਕੱਲ੍ਹ ਨੂੰ ਜਾਣਾ ਆ ਗੋਲਡਨ ਕੈਂਪ ਛੇ ਸਵਾਰੀਆਂ ਆਪਣੀਆਂ ਅਤੇ ਕੱਲ੍ਹ ਸੁਬਹ ਛੇ ਵਜੇ ਜਾਣਾ ਅਤੇ ਸ਼ਾਮ ਨੂੰ ਛੇ ਸੱਤ ਵਜੇ ਵਾਪਸ ਆ ਜਾਣਾ ਅਤੇ ਕੱਲ੍ਹ ਕਿੰਨੇ ਪੈਸੇ ਲਉਗੇ ਅਤੇ ਅਡਰੈਸ ਸਮਝ ਲਓ ਸਾਡਾ ਪਰਮਜੀਤ ਸਿੰਘ ਗਲੀ ਨੰਬਰ ਤਿੰਨ ਵਟਾ ਅੱਠ ਬਾਬਾ ਦੀਪ ਸਿੰਘ ਨਗਰ ਬਠਿੰਡਾ